ਜੀ ਬਿਲਕੁਲ ਆਪਾਂ ਮੈਂ ਖੁਦ ਵੀ ਇੱਕ ਕਾਵਿ ਲਿਖਿਆ ਸੀ ਕਿਸੇ ਲਈ ਆਪਣੀ ਇੱਕ ਸਹੇਲੀ ਲਈ ਲਿਖਿਆ ਸੀ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਮੈਂ ਕਦੀ ਐਵੇਂ ਦਾ ਕੁਛ ਲਿਖਿਆ ਨਹੀਂ ਸੀਗਾ ਅਤੇ ਉਹਨੂੰ ਪਹਿਲੀ ਵਾਰੀ ਮੈਂ ਲਿਖਿਆ ਸੀਗਾ ਅਤੇ ਇਸ ਕਰਕੇ ਉਹਨੂੰ ਬਹੁਤ ਪਸੰਦ ਆਇਆ ਉਸ ਚੀਜ਼ ਅਤੇ ਕੁਛ ਲਾਇਨਸ ਜਿਹੜੀਆਂ ਸੀਗੀਆਂ ਉਹਦੀ ਲਾਈਫ ਦੇ ਨਾਲ ਕਾਫ਼ੀ ਜ਼ਿਆਦਾ ਰਿਲੇਟ ਕਰਦੀਆਂ ਸੀਗੀਆਂ ਇਹਦੇ ਕਰਕੇ ਉਹਨੂੰ ਕਾਫ਼ੀ ਜ਼ਿਆਦਾ ਪਸੰਦ ਆਇਆ ਔਰ ਫੇਰ ਆਪਾਂ ਦੋਨਾਂ ਨੇ ਮਿਲ ਕੇ ਉਹਨੂੰ ਹੋਰ ਅੱਗੇ ਕੋਂਟੀਨਿਊ ਵੀ ਕੀਤਾ ਉਹਨੂੰ ਕਾਫ਼ੀ ਅੱਗੇ ਵਧਾਇਆ ਤਾਂ ਕਿ ਉਹਨੂੰ ਆਪਾਂ ਕੁਛ ਇੱਕ ਹੋਰ ਅੱਗੇ ਵਧਾ ਕੇ ਪੋਇਮ ਦੀ ਸ਼ੇਪ ਦੇ ਸਕੀਏ ਵਧੀਆ ਸੀਗਾ ਉਹਨੂੰ ਵੀ ਵਧੀਆ ਲੱਗਾ ਮੈਨੂੰ ਵੀ ਅੱਛਾ ਲੱਗਾ ਕਿ ਉਹਨੂੰ ਅੱਛਾ ਲੱਗਾ ਉਹਦੀ ਲਾਈਫ ਦੇ ਨਾਲ ਰਿਲੇਟਡ ਜੋ ਉਹਦੇ ਕਰੰਟ ਸਿਚੂਏਸ਼ਨ ਚੱਲ ਰਹੀ ਸੀਗੀ ਕੁਛ ਉਹ ਲਾਈਨਾਂ ਜਾਂ ਕੁਛ ਉਹਦੇ ਪਾਸਟ ਦੀਆਂ ਲਾਈਨਾਂ ਮੈਂ ਲੈ ਕੇ ਉਨ੍ਹਾਂ 'ਤੇ ਲਿਖਿਆ ਸੀਗਾ ਉਹਨੂੰ ਵੀ ਵਧ ਵਧੀਆ ਲੱਗਾ ਔਰ ਮੈਨੂੰ ਵੀ ਵਧੀਆ ਲੱਗਾ ਔਰ ਸੁਣਨ ਵਾਲੇ ਹੋਰ ਵੀ ਜਿਹੜੇ ਸੀਗੇ ਸਾਰਿਆਂ ਨੂੰ ਵੀ ਅੱਛਾ ਲੱਗਾ ਉਹਦੇ ਵਿੱਚ ਆਪਾਂ ਕੋਈ ਮਤਲਬ ਨਵੀਆਂ ਚੀਜ਼ਾਂ ਐਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਾਫ਼ੀ ਕੁਛ ਉਹਦੇ ਨਾਲ ਰਿਲੇਟਡ ਸਾਰਾ ਕੁਛ ਉਹਦਾ ਹੀ ਰਿਲੇਟਡ ਜਿਹੜਾ ਸੀਗਾ ਉਹਦੇ ਲਈ ਲਿਖਿਆ ਸੀਗਾ ਜਿਹਦੇ ਕਰਕੇ ਉਹਨੂੰ ਕਾਫ਼ੀ ਉਹ ਪਸੰਦ ਆਇਆ ਉਹਦੇ ਘਰਦਿਆਂ ਨੂੰ ਵੀ ਕਾਫ਼ੀ ਪਸੰਦ ਆਇਆ ਅਤੇ ਮੈਨੂੰ ਖੁਦ ਨੂੰ ਵੀ ਵਧੀਆ ਲੱਗਾ ਮੇਰੇ ਘਰਦਿਆਂ ਨੂੰ ਵੀ ਵਧੀਆ ਲੱਗਾ ਸਾਰਿਆਂ ਨੂੰ ਹੀ ਉਹ ਪਸੰਦ ਆਇਆ ਥੈਂਕ ਯੂ